ਜਦੋਂ ਮੈਂ ਆਪਣੇ ਘਰ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਕੰਮ ਕਰਦੇ ਦੌਰਾਨ ਮੇਰੇ ਘਰ ਦੀ ਟੂਟੀ ਦੇ ਵਿੱਚ ਪਾਣੀ ਘੱਟ ਆਉਣ ਲੱਗਾ ਜਿਸ ਦੇ ਕਾਰਨ ਮੈਨੂੰ ਲੱਗਾ ਕਿ ਸ਼ਾਇਦ ਮੇਰੇ ਘਰ ਦੀ ਟੈਂਕੀ ਦੇ ਵਿੱਚ ਪਾਣੀ ਵਾਲੀ 'ਚ ਪਾਣੀ ਖਤਮ ਹੋ ਗਿਆ ਜਦ ਮੈਂ ਉਹ ਚੈੱਕ ਕੀਤੀ ਜਦੋਂ ਮੈਂ ਟੈਂਕੀ ਚੈੱਕ ਕੀਤੀ ਤਾਂ ਉਸ ਦੇ ਵਿੱਚ ਪਾਣੀ ਪੂਰਾ ਸੀ ਬਟ ਫਿਰ ਮੈਂ ਆਪਣੇ ਘਰ ਦੇ ਸਾਰੀਆਂ ਟੂਟੀਆਂ ਨੂੰ ਚਲਾ ਕੇ ਦੇਖਿਆ ਤਾਂ ਸਾਰੀ ਟੂਟੀਆਂ ਦੇ ਵਿੱਚ ਪਾਣੀ ਇਸ ਤਰ੍ਹਾਂ ਪ੍ਰੈਸ਼ਰ ਦੇ ਰਾਹੀਂ ਨਹੀਂ ਆ ਰਿਹਾ ਸੀ ਤਾਂ ਮੈਨੂੰ ਪਤਾ ਲੱਗਾ ਕਿ ਇਸ ਇਹ ਪਿੱਛੋਂ ਹੀ ਕੋਈ ਮੁਸ਼ਕਲ ਆ ਰਹੀ ਹੈ ਤਾਂ ਮੈਨੂੰ ਮੇਰਾ ਘਰ ਦਾ ਸਾਰਾ ਕੰਮ ਹੀ ਪਿਆ ਸੀ ਹਾਲੇ ਮੈਂ ਸਾਫ ਸਫਾਈ ਹੀ ਕਰ ਰਹੀ ਸੀ ਜਦ ਮੈਨੂੰ ਦੇਖਿਆ ਕਿ ਮੇਰੇ ਸਾਰੇ ਕੱਪੜੇ ਧੋਣ ਵਾਲੇ ਨੇ ਕੱਪੜੇ ਧੋਣ ਦੇ ਨਾਲ ਨਾਲ ਮੇਰੇ ਬਰਤਨ ਵੀ ਸਾਫ ਕਰਨ ਵਾਲੇ ਸੀ ਤਾਂ ਮੈਂ ਉਹਨਾਂ ਦਾ ਨੰਬਰ ਹੈਲਪਲਾਈਨ ਨੰਬਰ ਤੋਂ ਗੂਗਲ ਦੇ ਤੋਂ ਲੱਭ ਰਹੀ ਸੀ ਕਿ ਉਹਨਾਂ ਨੂੰ ਮੈਂ ਹੈਲਪਲਾਈਨ ਨੰਬਰ ਤੋਂ ਕਾਲ ਕਰਕੇ ਕਿ ਮੈਂ ਆਪਣੀ ਜੋ ਕੀ ਹੈ ਕੰਪਲੇਂਟ ਦਰਜ ਕਰਵਾ ਸਕਾਂ ਤਾਂ ਜੋ ਕਿ ਉਹ ਕਾਰਵਾਈ ਕਰ ਸਕਣ ਕਿਉਂਕਿ ਮੈਨੂੰ ਮੇਰੇ ਪਾਣੀ ਨਾ ਆਉਣ ਕਾਰਨ ਮੇਰਾ ਬਹੁਤ ਜ਼ਿਆਦਾ ਮੈਨੂੰ ਮੁਸ਼ਕਲ ਆ ਰਹੀ ਹੈ ਜਿਸ ਕਰਕੇ ਮੇਰਾ ਸਾਰਾ ਹੀ ਕੰਮ ਰੁਕ ਗਿਆ ਹੈ ਅਤੇ ਮੇਰੇ ਸਾਰੇ ਘਰ ਦਾ ਕੰਮ ਪਾਣੀ ਬਿਨਾ ਅਧੂਰਾ ਹੈ ਸੋ ਮੈਂ ਉਹਨਾਂ ਨੂੰ ਹੈਲਪਲਾਈਨ ਨੰਬਰ 'ਤੇ ਬੇਨਤੀ ਕਰਨਾ ਚਾਹੁੰਦੀ ਹਾਂ ਧੰਨਵਾਦ